ਭੰਗੜਾ ਪੰਜਾਬ ਦੇ ਲੋਕਾਂ ਦੀ ਸ਼ਾਨ ਹੈ ਹਰ ਇੱਕ ਖੁਸ਼ੀ ਮੌਕੇ 'ਤੇ ਪਾਇਆ ਜਾਂਦਾ ਹੈ ਜਿੱਥੇ ਤਿਉਹਾਰ 'ਤੇ ਪਾਇਆ ਜਾਂਦਾ ਹੈ ਜ ਇਸ ਦੇ ਆਮ ਸਟੈਪ ਜਿਵੇਂ ਕਿ ਲੁੱਡੀ ਧਮਾਲ ਮਿਰਜਾ ਝੁੰਮਰ ਆਦਿ ਇਸ ਤਰ੍ਹਾਂ ਦੇ ਹੁੰਦੇ ਹਨ ਇਹ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਇਹ ਪੰਜਾਬ ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਹੈ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਹਨਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਅਤੇ ਤਿਉਹਾਰ ਆਦਿ ਸ਼ਾਮਿਲ ਹਨ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਲੋਕਧਾਰਾ ਵਿਗਿਆਨੀ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦ ਵਿੱਚ ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਿਹਰੀ ਸਿੱਟੇ ਪੈਂਦੇ ਵੇਖਿਆ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ ਲੰਮੀਆਂ ਘਾਲਣਾਂ ਅਤੇ ਕੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖਿਆਂ ਕਿਸ ਦਾ ਮਨ ਨਹੀਂ ਨੱਚ ਉੱਠਦਾ ਮੁੱਢ ਵਿੱਚ ਇਹ ਨਾਚ ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਹੈ ਇਹ ਸਾਡਾ ਸਭ ਤੋਂ ਭੰਗੜਾ ਪੰਜਾਬ ਦਾ ਬਹੁਤ ਵਧੀਆ ਨਾਚ ਹੈ ਅਤੇ ਇਹ ਵਧੀਆ ਗੱਭਰੂ ਭੰਗੜਾ ਪਾਉਂਦੇ ਹਨ ਅਤੇ ਇਹ ਖੁਸ਼ੀ ਦੇ ਮੌਕੇ 'ਤੇ ਵਿਆਹ ਸ਼ਾਦੀ ਦੇ ਮੌਕੇ 'ਤੇ ਚੰਗੀ ਤਰ੍ਹਾਂ ਭੰਗੜਾ ਕੀਤਾ ਜਾਂਦਾ ਹੈ ਸਾਡੇ ਜਦੋਂ ਅਸੀਂ ਵੀ ਕਿਸੇ ਦੇ ਵਿਆਹ 'ਤੇ ਜਾਂਦੇ ਹਾਂ ਤਾਂ ਉੱਥੇ ਉੱਥੇ ਵੀ ਭੰਗੜਾ ਦੇਖਣ ਨੂੰ ਮਿਲਦਾ ਹੈ ਅਤੇ ਬਹੁਤ ਖੁਸ਼ ਹੁੰਦਾ ਹੈ ਮਨ ਭੰਗੜੇ ਦੇ ਸਟੈਪ ਦੇਖ ਕੇ ਆਮ ਸਟੈਪ ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਜਿਵੇਂ ਕਿ ਲੁੱਡੀ ਧਮਾਲ ਮਿਰਜਾ ਝੁੰਮਰ ਇਸ ਤਰ੍ਹਾਂ ਨਾਲ